ਬੈਂਕਿੰਗ ਜਿਵੇਂ ਕਿ ਫੋਨ ਤੋਂ ਇੰਟਰਨਿਓਨੈਟ ਦੀ ਬੈਂਕਿੰਗ ਜਿਵੇਂ ਕਿ ਪੇਟੀਐੱਮ ਕਰਨਾ ਗੂਗਲ ਪੇ ਕਰਨਾ ਇਹ ਬਹੁਤ ਅੱਛਾ ਵੀ ਵਧੀਆ ਹੈ ਇਸ ਲਈ ਮੈਂ ਕਿਸੇ ਨੂੰ ਆਪਣਾ ਘਰੇ ਬੈਠੇ ਓ ਬੈਠੇ ਤੋਂ ਹੀ ਪੈਸੇ ਆਪਣਾ ਭੇਜ ਆਪਣਾ ਦਿੰਦਾ ਹਾਂ ਘਰ ਵਹ ਵੀ ਬੈਠੇ ਤੋਂ ਹੀ ਕਿਸੇ ਤੋਂ ਪੈਸੇ ਮੰਗਵਾ ਅੱਛਾ ਲੈ ਵੀ ਲੈਂਦਾ ਹਾਂ ਇਹ ਜੋ ਬੈਂਕਿੰਗ ਦੇ ਰਾਹੀਂ ਇੰਟਰਨੀਨੈੱਟ ਦੇ ਰਾਹੀਂ ਜਿਹੜੀ ਇਹ ਸਹੂਲਤ ਹੈ ਬਹੁਤ ਵਧੀਆ ਹੈ